ਅਸੀਂ ਸਾਰੇ ਹੀ ਜਾਣਦੇ ਹਾਂ ਕਿ ਛੋਟੇ ਵੱਡੇ ਤਕਨੀਕੀ ਮੁੱਦਿਆਂ ਨੂੰ ਹੱਲ ਕਰਨ ਦੇ ਵਿੱਚ ਸਾਡਾ ਗੂਗਲ ਸਾਡੀ ਮਦਦ ਕਰਦਾ ਹੈ ਭਾਵੇਂ ਕਿਸੇ ਤਰ੍ਹਾਂ ਦੀ ਤਕ ਤਕਨੀਕੀ ਮੁਸ਼ਕਿਲ ਹੋਵੇ ਲੋਕ ਉਸ ਦਾ ਸਾਹਮਣਾ ਕਰਦੇ ਹੋਣ ਸਾਨੂੰ ਗੂਗਲ ਰਾਹੀਂ ਉਸ ਮੁਸ਼ਕਿਲ ਦਾ ਹੱਲ ਮਿਲ ਜਾਂਦਾ ਹੈ ਅੱਜ ਕੱਲ੍ਹ ਆਨਲਾਈਨ ਤਕਨੀਕੀ ਮੁੱਦਿਆਂ ਦੇ ਹੱਲ ਬੜੇ ਆਰਾਮ ਨਾਲ ਲੱਭੇ ਜਾ ਸਕਦੇ ਹਨ ਛੋਟੇ ਵੱਡੇ ਤਕਨੀਕੀ ਮੁੱਦਿਆਂ ਨੂੰ ਹੱਲ ਕਰਨ ਦੇ ਵਿੱਚ ਇਹ ਗੂਗਲ ਸਾਡੀ ਮਦਦ ਕਰਦਾ ਹੈ ਅੱਜ ਛੋਟੇ ਤੋਂ ਛੋਟਾ ਬੱਚਾ ਵੀ ਆਪਣੀ ਗੇਮ ਨੂੰ ਗੂਗਲ ਰਾਹੀਂ ਆਸਾਨੀ ਤਰੀਕੇ ਦੇ ਨਾਲ ਖੇਡਦਾ ਹੈ ਜਦੋਂ ਵੀ ਕੋਈ ਪ੍ਰਸ਼ਨ ਜਾਂ ਕੋਈ ਤਕਨੀਕੀ ਮਸਲਾ ਚਾਹੇ ਉਹ ਸਾਇੰਸ ਵਿਗਿਆਨ ਸ਼ਸੋਲੋਜੀ ਸਰੀਰਕ ਸਿੱਖਿਆ ਜਾਂ ਹਿਸਾਬ ਗਣਿਤ ਦੇ ਵਿੱਚ ਹੋਵੇ ਇਹ ਮੁੱਦੇ ਗੂਗਲ ਰਾਹੀਂ ਇੱਕ ਸੈਕਿੰਟ ਦੇ ਵਿੱਚ ਹੱਲ ਕੀਤੇ ਜਾ ਸਕਦੇ ਹਨ ਧੰਨਵਾਦ